ਜੈਵਿਕ ਵਿਭਿੰਨਤਾ ਸਾਡੇ ਬਾਗ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ ਸਭ ਤੋਂ ਪਹਿਲਾਂ ਤਾਂ ਅਸੀਂ ਜੈਵਿਕ ਵਿਭਿੰਨਤਾ ਦਾ ਅਰਥ ਦੱਸਾਂਗੇ ਜੈਵਿਕ ਵਿਭਿੰਨਤਾ ਦਾ ਅਰਥ ਉਹ ਹੀ ਪਤਾ ਲੱਗਦਾ ਹੈ ਕਿ ਦੋ ਜੀਵਾਂ ਦੇ ਵਿੱਚ ਭਿੰਨ ਹੋਣਾ ਜਿਵੇਂ ਮਨੁੱਖ ਮਨੁੱਖ ਦੇ ਵਿੱਚ ਵੀ ਅ ਅਲੱਗ ਅਲੱਗ ਭਿੰਨ ਅਲੱਗ ਅਲੱਗ ਤਰ੍ਹਾਂ ਦਾ ਭਿੰਨ ਹੁੰਦਾ ਹੈ ਅਤੇ ਦੋ ਜੀਵਾਂ ਦੇ ਵਿੱਚ ਵੀ ਅਲੱਗਅਲੱਗ ਭਿੰਨ ਹੁੰਦੀ ਹੈ ਅਤੇ ਜਿਵੇਂ ਮਨੁੱਖ ਕੋਈ ਮੋਟਾ ਹ ਕੋਈ ਕੋਈ ਮੁ ਮੋਟਾ ਹੁੰਦਾ ਅਤੇ ਕੋਈ ਪਤਲਾ ਹੁੰਦਾ ਹੈ ਜਿਵੇਂ ਜੀਵ ਕੋਈ ਚਾਰ ਪੈਰਾਂ ਵਾਲਾ ਹੁੰਦਾ ਕੋਈ ਦੋ ਪੈਰਾਂ ਵਾਲਾ ਹੁੰਦਾ ਇਸ ਤਰ੍ਹਾਂ ਜੈਵਿਕ ਵਿਭਿੰਨਤਾ ਸਾਡੇ ਸਮਾਜ ਸਾਡੇ ਇਨਵਾਇਰਮੈਂਟ ਦੇ ਵਿੱਚ ਪਾਈ ਜਾਂਦੀ ਹੈ ਜੈਵਿਕ ਵਿਭਿੰਨਤਾ ਦੇ ਨਾਲ ਨਾਲ ਵੱਧ ਤੋਂ ਵੱਧ ਜਾਨਵਰ ਅ ਜਾਨਵਰਾਂ ਨੂੰ ਵੱਧ ਤੋਂ ਵੱਧ ਦਰੁ ਦਰੱਖਤ ਲਾਵਾਂਗੇ ਫ਼ਲ ਲਾਵਾਂਗੇ ਤੇ ਵੱਧ ਤੋਂ ਵੱਧ ਜੈਵਿਕ ਵਿਭਿੰਨਤਾ ਅ ਪਾਈ ਜਾਂਦੀ ਹੈ ਅਤੇ ਇਸ ਨਾਲ ਜਿਵੇਂ ਅ ਦੋ ਜਾਨਵਰਾਂ ਵਾਲੇ ਪੈਰਾਂ ਵਾਲੇ ਜਾਨਵਰ ਹੁੰਦੇ ਆ ਚਾਰ ਪੈਰਾਂ ਵਾਲੇ ਹੁੰਦੇ ਆ ਅਤੇ ਇਸ ਤਰ੍ਹਾਂ ਸਮਾਜ ਦੇ ਵਿੱਚ ਜਿਹੜੇ ਬੱਚੇ ਆ ਜਾਂ ਸਾਡੇ ਅ ਆਲੇ ਦੁਆਲੇ ਦੇ ਲੋਕ ਆ ਗਏ ਇ ਜੈਵਿਕ ਵਿਭਿੰਨਤਾ ਬਾਰੇ ਸਿੱਖਦੇ ਆ ਅਤੇ ਇਸ ਨਾਲ ਸਾਡੇ ਜੈਵਿਕ ਵਿਭਿੰਨਤਾ ਜਿਹੜਾ ਸਰਕਲ ਹੈ ਉਹ ਚੱਲਦਾ ਰਹਿੰਦਾ ਹੈਗਾ ਅਤੇ ਇਸ ਤਰ੍ਹਾਂ ਜੈਵਿਕ ਵਿਭਿੰਨਤਾ ਆ ਗਈ ਸਾਡੇ ਅ ਸਮਾਜ ਸੁਸਾਇਟੀ ਭਾਰਤ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਜੈਵਿਕ ਵਿਭਿੰਨਤਾ ਨਾਲ ਵੱਖ ਵੱਖ ਤਰ੍ਹਾਂ ਦੀਆਂ ਆਪਾਂ ਨੂੰ ਅ ਭੂਮਿਕਾ ਨਿਭਾਉਣੀਆਂ ਪੈਂਦੀਆਂ ਜਿਵੇਂ ਜੈਵਿਕ ਵਿਭਿੰਨਤਾ ਦੇ ਵਿੱਚ ਦੋ ਮਨੁੱਖ ਹੈ ਅਲੱਗ ਅਲੱਗ ਹੁੰਦੇ ਆ ਉਸੇ ਤਰ੍ਹਾਂ ਹੀ ਦੋ ਜੀਵ ਹੈ ਕੋਈ ਚਾਰ ਪੈਰਾਂ ਵਾਲਾ ਹੁੰਦਾ ਕੋਈ ਦੋ ਪੈਰਾਂ ਵਾਲਾ ਹੁੰਦਾ ਜਿ ਜਿਵੇਂ ਇਨਸਾਨ ਹੈਗਾ ਇਨਸਾਨ ਕੋਈ ਮੋਟਾ ਹੁੰਦਾ ਪਤਲਾ ਹੁੰਦਾ ਅਤੇ ਇਹ ਹੀ ਜੈਵਿਕ ਵਿਭਿੰਨਤਾ ਵਿੱਚ ਫ਼ਰਕ ਹੈ ਅਤੇ ਇਸ ਨੂੰ ਅਸੀਂ ਉਤਸ਼ਾਹ ਕਿਵੇਂ ਕਰ ਸਕਦੇ ਹਾਂ ਇਹਨੂੰ ਉਤਸ਼ਾਹ ਅਸੀਂ ਐਂ ਕਰ ਸਕਦੇ ਹੈਗੇ ਵੱਧ ਤੋਂ ਵੱਧ ਅਸੀਂ ਪੇੜ ਪੌਦੇ ਲਾਵਾਂਗੇ ਉਹਦੇ ਵਿੱਚ ਵੱਖ ਵੱਖ ਤਰ੍ਹਾਂ ਦੀ ਡ ਅ ਜੈਵਿਕ ਵਿਭਿੰਨਤਾ ਦੇਖਣ ਨੂੰ ਮਿਲਦੀ ਹੈ ਜਿਵੇਂ ਅ ਦੋ ਪੰ ਦੋ ਜਾਨਵਰ ਹੁੰਦੇ ਆ ਦੋ ਜਾਨਵਰ ਪੰਛੀ ਹੋ ਗਏ ਅਤੇ ਕੀੜੇ ਮਕੌੜੇ ਹੋ ਗਏ ਇਹ ਸਾਰੇ ਕੀ ਆ ਜੈਵਿਕ ਵਿਭਿੰਨਤਾ ਹੈਗੀ ਇਹਦੇ ਨਾਲ ਕੀ ਆ ਸਮਾਜ ਦਾ ਸਾਰਾ ਸਟਰਕਚਰ ਹੈ ਉਹ ਚੱਲਦਾ ਰਹਿੰਦਾ ਗਾ ਇਸ ਤਰ੍ਹਾਂ ਜੈਵਿਕ ਵਿਭਿੰਨਤਾ ਕੀ ਹੈ ਸਾਡੇ ਸਮਾਜ ਅਤੇ ਸਾਡੇ ਬਾਗ ਵੇ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ ਹੈ